ਯੋਗਾ ਹਰ ਉਮਰ ਵਿੱਚ ਜ਼ਰੂਰੀ ਹੈ ਯੋਗਾ ਹਰ ਉਮਰ ਦੇ ਵਿਅਕਤੀ ਲਈ ਆਪਣੇ ਤੌਰ 'ਤੇ ਇੱਕ ਨਵਾਂ ਊਰਜਾ ਪ੍ਰਦਾਨ ਕਰਦਾ ਹੈ ਬੱਚਿਆਂ ਲਈ ਯੋਗਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਵਧਣ ਫੁੱਲਣ ਦੀ ਉਮਰ ਹੈ ਯੋਗਾ ਨਾ ਉਹਨਾਂ ਦਾ ਕੱਦ ਵਧੇਗਾ ਉਹਨਾਂ ਦੇ ਸਰੀਰ ਵਿੱਚ ਲਚਕ ਆਵੇਗੀ ਅਤੇ ਉਹ ਆਪਣੇ ਪੜ੍ਹਾਈ ਵਿੱਚ ਵੀ ਬੜੀ ਚੰਗੇ ਤਰੀਕੇ ਨਾਲ ਧਿਆਨ ਲਗਾ ਸਕਣਗੇ ਵੱਡੀ ਉਮਰ ਦੇ ਲੋਕ ਜਿਹੜੇ ਆਪਣੇ ਨੌਕਰੀ 'ਤੇ ਜਾਂਦੇ ਨੇ ਆਪਦੇ ਕੰਮਾਂ ਕਾਰਾਂ 'ਤੇ ਜਾਂਦੇ ਨੇ ਅਤੇ ਆਪਣੇ ਸਰੀਰਕ ਨੂੰ ਓਨਾ ਸਮਾਂ ਨਹੀਂ ਦੇ ਸਕਦੇ ਉਹਨਾਂ ਲਈ ਵੀ ਯੋਗਾ ਬਹੁਤ ਜ਼ਰੂਰੀ ਇਸ ਨਾਲ ਮਨ ਦੇ ਇਕਾਗਰਤਾ ਸਰੀਰ ਦੀ ਤੰਦਰੁਸਤੀ ਸਰੀਰ ਦੀ ਲਚਕਤਾ ਆਉਂਦੀ ਹੈ ਅਤੇ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਵੀ ਵੱਧਦੀ ਹੈ ਬੁਢਾਪੇ ਦੇ ਵਿੱਚ ਜੋ ਲੋਕ ਹਨ ਉਹ ਸਖਤ ਐਕਸ਼ਾਈਜਾਂ ਨਹੀਂ ਕਰ ਸਕਦੇ ਜਿੰਮ ਨਹੀਂ ਜਾ ਸਕਦੇ ਕੋਈ ਜ਼ਿਆਦਾ ਵਜਨ ਨਹੀਂ ਉਠਾ ਸਕਦੇ ਤਾਂ ਉਹਨਾਂ ਲਈ ਯੋਗਾ ਇੱਕ ਰਾਮ ਬਾਣ ਹੈ ਕਿਉਂਕਿ ਯੋਗਾ ਕਰਨ ਦੇ ਨਾਲ ਨਾਲ ਉਹ ਆਪਣੇ ਬੁਢਾਪੇ ਵਿੱਚ ਹੱਡੀਆਂ ਦੀਆਂ ਬਿਮਾਰੀਆਂ ਹਨ ਜੋ ਗੋਡੇ ਦਰਦ ਹੁੰਦੇ ਹਨ ਜੋੜਾਂ ਦੀਆਂ ਸਮੱਸਿਆ ਉਹਨਾਂ ਤੋਂ ਤਾਂ ਦੂਰ ਹੋਣਗੇ ਹੀ ਹੋਣਗੇ ਅਤੇ ਆਪਦੀ ਪਾਚਣ ਸ਼ਕਤੀ ਨੂੰ ਅਤੇ ਆਪਦੀ ਸੋਚਣ ਸ਼ਕਤੀ ਨੂੰ ਵੀ ਚੰਗਾ ਬਣਾ ਸਕਦੇ ਹਨ ਇਸ ਲਈ ਹਰ ਉਮਰ ਦੇ ਲੋਕਾਂ ਲਈ ਯੋਗਾ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ